ਮੈਨੂੰ ਮੋਟਰਸਾਈਕਲ ਬਾਈਕਿੰਗ ਬਹੁਤ ਵਧੀਆ ਲੱਗਦੀ ਹੈ ਅਤੇ ਮੈਂ ਤਕਰੀਬਨ ਆਪਣੇ ਕੰਮ 'ਤੇ ਜਦੋਂ ਵੀ ਜਾਂਦਾ ਤਾਂ ਮੈਂ ਆਪਦੇ ਮੋਟਰਸਾਈਕਲ 'ਤੇ ਜਾਂਦਾ ਅਤੇ ਫਿਰ ਇੱਕ ਵਾਰੀ ਤਕਰੀਬਨ ਸਾਡੇ ਯਾਰ ਦੋਸਤਾਂ ਬੈਠੇ ਸੀ ਅਸੀਂ ਗੱਲਾਂ ਬਾਤਾਂ ਚੱਲ ਪਈਆਂ ਕੀ ਕਰੀਏ ਕਹਿੰਦੇ ਯਾਰ ਘੁੰਮਣ ਚਲਦੇ ਹਾਂ ਉਹ ਵੀ ਮੋਟਰਸਾਈਕਲ 'ਤੇ ਚਲਦੇ ਹਾਂ ਯਾਰ ਪਹਿਲਾਂ ਤਾਂ ਅਸੀਂ ਸੋਚਦੇ ਰਹੇ ਯਾਰ ਮੋਟਰਸਾਈਕਲ 'ਤੇ ਕਈ ਮੌਸਮ ਬਦਲ ਗਿਆ ਮੀਂਹ ਝੱਖੜ ਆ ਗਿਆ ਕੀ ਕਰਾਂਗੇ ਉਹ ਕਹਿੰਦੇ ਨਹੀਂ ਯਾਰ ਆਪਾਂ ਸਾਰਾ ਕੁਛ ਨਾਲ ਰੱਖਾਂਗੇ ਮੌਸਮ ਵੀ ਵਧੀਆ ਚਲਦੇ ਹਾਂ ਅਤੇ ਸਾਡਾ ਨਾ ਸ਼ਿਮਲੇ ਜਾਣ ਦਾ ਪਲੈਨ ਬਣ ਗਿਆ ਅਸੀਂ ਇੱਥੋਂ ਸਵੇਰ ਦੇ ਨਿਕਲ ਗਏ ਜਲਦੀ ਜਲਦੀ 'ਚ ਤਿੰਨ ਚਾਰ ਜਾਣੇ ਸੀਗੇ ਬੁਲਟ ਮੋਟਰਸਾਈਕਲ ਸੀਗੇ ਅਤੇ ਰਸਤੇ 'ਚ ਜਾਂਦੇ ਜਾਂਦੇ ਅਸੀਂ ਪਹਿਲਾਂ ਰੁਕੇ ਰਾਜਪੁਰੇ ਰੁਕੇ ਉੱਥੇ ਬ੍ਰੇਕਫਾਸਟ ਵਗੈਰਾ ਕੀਤਾ ਫੇਰ ਉਹ ਤੋਂ ਬਾਅਦ ਅਸੀਂ ਵਿੱਚ ਦੀ ਖੜ੍ਹ ਜਾਂਦੇ ਸੀਗੇ ਜਿੱਥੇ ਵਧੀਆ ਵਿਊ ਹੁੰਦਾ ਫੋਟੋਆਂ ਕਰਾ ਲੈਂਦੇ ਫਿਰ ਮੋਟਰਸਾਈਕਲ 'ਤੇ ਸਵਾਰੀ ਕਰਨ ਲੱਗ ਜਾਂਦੇ ਅਤੇ ਹਾਂ ਅਤੇ ਐਨਾ ਹੀ ਵਧੀਆ ਰਿਹਾ ਫਿਰ ਅਸੀਂ ਅਖੀਰ ਨੂੰ ਕਰਦੇ ਕਰਾਉਂਦੇ ਉੱਥੇ ਸ਼ਿਮਲੇ ਪਹੁੰਚ ਗਏ ਸ਼ਿਮਲੇ 'ਤੇ ਮ ਇੱਕ ਤਾਂ ਮੌਸਮ ਐਨਾ ਸੋਹਣਾ ਸੀ ਇੱਕ ਤਾਂ ਅਸੀਂ ਰਸਤੇ 'ਚ ਖੜ੍ਹਾ ਕੇ ਫ ਮੋਟਰਸਾਈਕਲ ਫਿਰ ਉੱਥੇ ਫੋਟੋਆਂ ਕਰਦੇ ਸੈਲਫੀਆਂ ਕਰਦੇ ਫਿਰ ਅਸੀਂ ਰਸਤੇ 'ਚ ਕਈ ਵਾਰ ਸ਼ੋਪ 'ਤੇ ਰੋਕ ਲੈਂਦੇ ਖਾਣ ਨੂੰ ਕੁਛ ਨਾ ਕੁਛ ਲੈ ਲੈਂਦੇ ਮਾੜਾ ਮੋਟਾ ਪਿੱਛੇ ਬੈਠੇ ਵਾਲੇ ਨਾਲ ਨਾਲ ਰਲ ਰੁਕ ਕੇ ਖਾ ਪੀ ਲੈਂਦੇ ਅਤੇ ਮੈਨੂੰ ਬਹੁਤ ਵਧੀਆ ਆਨੰਦ ਆਇਆ ਅਤੇ ਮੈਂ ਵੀ ਚਾਹੁੰਦਾ ਕਿ ਅੱਗੇ ਤੋਂ ਵੀ ਇਹੋ ਇਹ ਟੂਰ ਬਣਦੇ ਰਹਿਣ ਮੋਟਰਸਾਈਕਲ ਵਾਲੇ ਅਤੇ ਅਸੀਂ ਜਾਂਦੇ ਰਹੀਏ ਸੇਫ ਡਰਾਈਵਿੰਗ ਚਲਦੇ ਰਹੀਏ